ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਵਪ੍ਰੀਤ ਸਿੰਘ ਬੋਲ ਰਿਹਾ ਜੀ ਮੈਂ ਹੁਣ ਤੋਂ ਦਸ ਮਿੰਟ ਪਹਿਲਾਂ ਕੈਬ ਬੁੱਕ ਕੀਤੀ ਸੀ ਤੁਹਾਡੀ ਸਾਈਟ ਤੋਂ ਅਤੇ ਤੁਹਾਡੀ ਸਾਈਟ 'ਤੇ ਦਿਖਾ ਰਹੇ ਸੀ ਵੀ ਦੋ ਤੋਂ ਤਿੰਨ ਮਿੰਟ ਵਿੱਚ ਕੈਬ ਆ ਜੇਗੀ ਪਰ ਹਜੇ ਤੱਕ ਦਸ ਮਿੰਟ ਬੀਤ ਜਾਣ ਤੋਂ ਬਾਅਦ ਵੀ ਕੈਬ ਹਜੇ ਤੱਕ ਆਈ ਨਹੀਂ ਹੈ ਮੈਂ ਹੁਣ ਮੈਂ ਕਿਤੇ ਬਹੁਤ ਜਲਦੀ ਪਹੁੰਚਣਾ ਸੀ ਪਰ ਤੁਹਾਡੀ ਕੈਬ ਨਾ ਆਉਣ ਕਰਕੇ ਮੈਂ ਕੋਈ ਹੋਰ ਕੈਬ ਬੁੱਕ ਕਰ ਲਈ ਹੈ ਮੈਂ ਤੁਹਾਡੀ ਕੈਬ ਨੂੰ ਰੱਦ ਕਰਨਾ ਚਾਹੁੰਦਾ ਅਤੇ ਮੇਰਾ ਜਿਹੜੇ ਜਿਹੜੇ ਪੈਸੇ ਤੁਸੀਂ ਪਹਿਲਾਂ ਮੇਰੇ ਤੋਂ ਲੈ ਲਏ ਹੋਏ ਨੇ ਅਤੇ ਉਹ ਪਲੀਜ਼ ਉਹ ਕਿਰਪਾ ਕਰਕੇ ਵਾਪਸ ਕਰ ਦਿਓ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂ